ਮੈਂ ਛੋਟੀ ਹੁੰਦੀ ਤੋਂ ਹੀ ਖੇਡਾਂ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਰੱਖਦੀ ਹਾਂ ਮੈਂ ਬਹੁਤ ਸਾਰੀਆਂ ਖੇਡਾਂ ਦੇ ਵਿੱਚ ਪਾਰਟੀਸਪਾਟ ਪਾਰਟੀਸਪੇਟ ਕੀਤਾ ਅਤੇ ਬਹੁਤ ਸਾਰੀਆਂ ਪ੍ਰਾਪਤੀਆਂ ਖੇਡਾਂ ਵਿੱਚ ਪ੍ਰਾਪਤ ਕੀਤੀਆਂ ਜਿਸ ਦੇ ਨਾਲ ਮੈਨੂੰ ਬਹੁਤ ਸਾਰੇ ਮੈਡਲਸ ਪ੍ਰਾਪਤ ਹੋਏ ਅਤੇ ਇਜ ਪਲੱਸ ਟੂ ਦੇ ਵਿੱਚ ਮੈਂ ਇੱਕ ਦੌੜ ਦੇ ਵਿੱਚ ਹਿੱਸਾ ਲਿਆ ਸੀ ਜਿਸਦੇ ਵਿੱਚ ਮੈਨੂੰ ਥੋੜ੍ਹੇ ਦੌੜ ਤੋਂ ਥੋ ਥੋੜ੍ਹੇ ਦਿਨ ਪਹਿਲਾਂ ਮੇਰੇ ਪੈਰ 'ਤੇ ਸੱਟ ਲੱਗ ਗਈ ਸੀ ਪਰ ਇਸ ਦੇ ਬਾਵਜੂਦ ਵੀ ਮੈਂ ਪਹਿਲ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ